ਹਾਂਜੀ ਜਦੋਂ ਅਸੀਂ ਕੁਛ ਵੀ ਮਤਲਬ ਡਰੋਅ ਕਰਨਾ ਹੁੰਦਾ ਹੈ ਜਾਂ ਚਿੱਤਰ ਬਣਾਉਣਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਆਪਣੇ ਦਿਮਾਗ ਵਿੱਚ ਉਹ ਚੀਜ਼ ਨੂੰ ਸੋਚਦੇ ਹਾਂ ਵੀ ਅਸੀਂ ਕੀ ਚੀਜ਼ ਬਣਾਉਣੀ ਹੈਗੀ ਆ ਫਿਰ ਅਸੀਂ ਉਹਦੇ ਅਕ ਜਿਹੜੀ ਚੀਜ਼ ਚਾਹੀਦੀ ਹੁੰਦੀ ਆ ਉਹ ਡਰੋਅ ਕਰਨ ਲਈ ਬੋਰਡ ਪੈਨਸਲ ਕਲਰ ਮੀਨਜ਼ ਵੀ ਕਿਹੜੇ ਲਾਈਟ ਜਾਂ ਡਾਰਕ ਜਾਂ ਵਾਟਰ ਕਲਰ ਜਾਂ ਕ੍ਰੋਨ ਕਲਰ ਜਿਹੜੇ ਵੀ ਚਾਹੀਦੇ ਹਨ ਉਹ ਸਾਰੇ ਕਲਰ ਇਕੱਠੇ ਕਰਦੇ ਹਾਂ ਫਿਰ ਅਸੀਂ ਪੈਨਸਲ ਨਾਲ ਉਸ ਜਿਹੜਾ ਅਸੀਂ ਆਪਣੇ ਦਿਮਾਗ ਵਿੱਚ ਸੀਨ ਸੋਚਿਆ ਹੁੰਦਾ ਹੈ ਅਸੀਂ ਉਹਨੂੰ ਮਤਲਬ ਕਿ ਪੈਨਸਲ ਦੇ ਨਾਲ ਹਲਕਾ ਹਲਕਾ ਡਰੋਅ ਕਰਦੇ ਹਾਂ ਜਦੋਂ ਹੁਣ ਉਹ ਚਿੱਤਰ ਸਾਨੂੰ ਲੱਗਦਾ ਹੈ ਕਿ ਹਾਂ ਇਹ ਸਾਰਾ ਸਹੀ ਬਣ ਗਿਆ ਹੈ ਮਤਲਬ ਕਿ ਕਿੱਥੇ ਕਿਹੜੇ ਕ ਹ ਕਲਰ ਕੀ ਰੰਗ ਆਪਾਂ ਵਰਤਣੇ ਹਨ ਕਿਹੜੀ ਚੀਜ਼ ਬਣਾਉਣੀ ਹੈ ਜਿਵੇਂ ਕਿ ਹੁਣ ਆਪਾਂ ਪੇੜ ਜਾਂ ਕੋਈ ਝੌਂਪੜੀ ਬਣਾਉਣੀ ਹੈ ਅਤੇ ਆਪਾਂ ਉਹਦੇ ਵਿੱਚ ਕੀ ਖਿੜਕੀਆਂ ਬਣਾ ਰਹੇ ਹਾਂ ਕਿਵੇਂ ਛੱਤ ਬਣਾ ਰਹੇ ਹਾਂ ਅਗਰ ਆਪਾਂ ਜੇ ਦਰੱਖਤ ਬਣਾ ਰਹੇ ਹਾਂ ਤਾਂ ਆਪਾਂ ਦਰੱਖਤ ਨੂੰ ਕਿਵੇਂ ਬਣਾ ਰਹੇ ਹਾਂ ਦਰੱਖਤ ਨੂੰ ਆਪਾਂ ਜ਼ਿਆਦਾ ਭਾਰਾ ਬਣਾ ਰਹੇ ਹਾਂ ਛੋਟਾ ਬਣਾ ਰਹੇ ਹਾਂ ਜਾਂ ਇਸ ਨੂੰ ਜ਼ਿਆਦਾ ਵੱਡਾ ਬਣਾ ਰਹੇ ਹਾਂ ਜਾਂ ਦਰੱਖਤ ਦੇ ਆਸੇ ਪਾਸੇ ਆਪਾਂ ਕੀ ਦ੍ਰਿਸ਼ ਬਣਾਉਣੇ ਹਨ ਬੱਦਲ ਬਣਾਉਣੇ ਹਨ ਜਾਂ ਆਪਾਂ ਕੋਈ ਘਰ ਬਣਾਉਣਾ ਹੈ ਜਾਂ ਝੌਂਪੜੀ ਬਣਾਉਣੀ ਹੈ ਕੀ ਬਣਾਉਣਾ ਹੈ ਉਹ ਸਾਰਾ ਕੁਛ ਆਪਾਂ ਇਹਦੇ ਵਿੱਚ ਪਹਿਲਾਂ ਸੋਚਦੇ ਹਾਂ ਫਿਰ ਉਹਦੇ ਉਹਨੂੰ ਉਸ ਦੇ ਵਿੱਚ ਵਰਤੇ ਜਾਣ ਵਾਲੇ ਕਲਰ ਰੰਗ ਉਹਦੇ ਆਪਾਂ ਉਹ ਸਾਰੇ ਕੁਛ ਅ ਕਰਦੇ ਹਾਂ ਅਤੇ ਉਸ ਨੂੰ ਹਲਕਾ ਜਾਂ ਗੂੜਾ ਜਾਂ ਹਲਕਾ ਕਿਹੜਾ ਆਪਾਂ ਦੇਣਾ ਹੈਗਾ ਉਹ ਆਪਾਂ ਕਲਰ ਉਸ ਹਿਸਾਬ ਨਾਲ ਉਸ ਨੂੰ ਆਪਾਂ ਦਿੰਦੇ ਹਾਂ ਅਤੇ ਉਹਨੂੰ ਵੱਧ ਤੋਂ ਵੱਧ ਮਤਲਬ ਪੂਰਾ ਸਾਫ਼ ਸੋਹਣਾ ਅਤੇ ਮਤਲਬ ਆਕ ਆਰਕਸ਼ ਆਕਰਸ਼ਕ ਬਣਾਉਦੇ ਹਾਂ ਤਾਂ ਜੋ ਉਹ ਅ ਦੇਖਣ ਵਾਲੇ ਨੂੰ ਅਤੇ ਬਣਾਉਣ ਵਾਲੇ ਨੂੰ ਵਧੀਆ ਲੱਗੇ